ਸਤਿ ਸ਼੍ਰੀ ਅਕਾਲ ਜੀ ਮੈਂ ਭਾਵੀਕਾ ਜ਼ਿਲ੍ਹਾ ਨਿਵਾਸੀ ਪਠਾਨਕੋਟ ਤੋਂ ਬੋਲ ਰਹੀ ਹਾਂ ਅੱਜ ਮੈਂ ਤੁਹਾਡੇ ਨਾਲ ਟੈਕਨੋਲੋਜੀ ਨੇ ਸਾਡੇ ਯਾਤਰਾ ਕਰਨ ਅਤੇ ਸੰਸਾਰ ਦੀ ਪੜਚੋਲ ਕਰਨ ਦੇ ਤਰੀਕੇ ਨੂੰ ਕਿਵੇਂ ਬਦਲਿਆ ਹੈ ਇਸ ਵਿਸ਼ੇ ਆਪਣੇ ਵਿਚਾਰ ਸਾਂਝੇ ਕਰਾਂਗੀ ਅਸੀਂ ਸਾਰੇ ਅੱਜ ਕੱਲ੍ਹ ਦੀ ਵਧਦੀ ਟੈਕਨੋਲੋਜੀ ਬਾਰੇ ਤਾਂ ਜਾਣਦੇ ਹੀ ਹਾਂ ਜਿਵੇਂ ਕਿ ਪਹਿਲਾਂ ਲੋਕ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜ ਜਾਣ ਲਈ ਪੈਦਲ ਜਾਂਦੇ ਸੀ ਜਿਸ ਨਾਲ ਜੇ ਉਹਨਾਂ ਨੇ ਕਈ ਵਾਰ ਦੂਰ ਜਾਣਾ ਹੁੰਦਾ ਸੀ ਤਾਂ ਉਹਨਾਂ ਨੂੰ ਕਈ ਵਾਰ ਤਾਂ ਹਫਤੇ ਵੀ ਲੱਗ ਜਾਂਦੇ ਸੀ ਫਿਰ ਮਨੁੱਖ ਦੁਆਰਾ ਟਾਂਗੇ ਦਾ ਅਵਿਸ਼ਕਾਰ ਕੀਤਾ ਗਿਆ ਜਿਸ ਨਾਲ ਮਨੁੱਖ ਦਾ ਜੀਵਨ ਥੋੜ੍ਹਾ ਆਸਾਨ ਹੋਇਆ ਪਰ ਅੱਜ ਕੱਲ੍ਹ ਤਾਂ ਟੈਕਨੋਲੋਜੀ ਇੰਨੀ ਤਰੱਕੀ ਕਰ ਚੁੱਕੀ ਹੈ ਕਿ ਜਿੱਥੇ ਜਾਣ ਲਈ ਪਹਿਲਾਂ ਚਾਰ ਚਾਰ ਦਿਨ ਲੱਗਦੇ ਸੀ ਜਾਂ ਹਫਤੇ ਲੱਗਦੇ ਸੀ ਉੱਥੇ ਜਾਣ ਲਈ ਹੁਣ ਸਿਰਫ ਕੁਝ ਘੰਟੇ ਲੱਗਦੇ ਹਨ ਪਹਿਲਾਂ ਜੇ ਮਨੁੱਖ ਕਿਸੇ ਨਵੀਂ ਥਾਂ 'ਤੇ ਜਾਂਦਾ ਸੀ ਤਾਂ ਉਸ ਨੂੰ ਕਈ ਲੋਕਾਂ ਤੋਂ ਪੁੱਛ ਕੇ ਜਾਣਾ ਪੈਂਦਾ ਸੀ ਪਰ ਹੁਣ ਤਾਂ ਮੋਬਾਇਲ ਫੋਨ ਵਿੱਚ ਹੀ ਐਸੇ ਫੀਚਰ ਹਨ ਕਿ ਅਸੀਂ ਕਿਤੇ ਵੀ ਜਾਣਾ ਹੋਏ ਤਾਂ ਫੋਨ 'ਤੇ ਲੋਕੇਸ਼ਨ ਸਰਚ ਕਰਕੇ ਜਾ ਸਕਦੇ ਹਾਂ ਅੱਜ ਕੱਲ੍ਹ ਦੀ ਟੈਕਨੋਲੋਜੀ ਦੇ ਸਾਡੇ ਲਈ ਬਹੁਤ ਹੀ ਲਾਭ ਹਨ ਧੰਨਵਾਦ